ਮੈਨੂੰ ਬਚਪਨ ਤੋਂ ਹੀ ਫੋਟੋਆਂ ਖਿੱਚਣ ਦਾ ਅਤੇ ਖਿਚਵਾਉਣ ਦਾ ਬਹੁਤ ਹੀ ਸ਼ੌਂਕ ਸੀ ਅਜ ਅਤੇ ਜਦੋਂ ਮੈਂ ਆਪਣੀਆਂ ਪੁਰਾਣੀਆਂ ਫੋਟੋਆਂ ਜਦੋਂ ਦੇਖਦੀ ਹਾਂ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਚੰਗਾ ਲੱਗਦਾ ਵਾ ਮੇਰੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ ਯਾਦ ਆਉਂਦਾ ਹਨ ਕਿ ਕਿਵੇਂ ਮੇਰੇ ਘਰ ਦੇ ਮੈਨੂੰ ਪੁੱਛਦੇ ਸੀ ਅਤੇ ਅੱਜ ਵੀ ਜਦੋਂ ਮੈਂ ਉਹ ਦੇਖਦੀ ਹਾਂ ਆਪਣਾ ਬਚਪਨ ਮੈਨੂੰ ਸਾਰਾ ਕੁਝ ਮੇਰਾ ਪੁਰਾਣਾ ਯਾਦ ਆਉਂਦਾ ਹੈ ਮੇਰੀਆਂ ਮਿੱਠੀਆਂ ਮਿੱਠੀਆਂ ਯਾਦਾਂ ਜੁੜੀਆਂ ਹਨ ਫੋਟੋਆਂ ਨਾਲ ਜੇ ਫੋਟੋਆਂ ਨਾ ਹੋਣ ਅਤੇ ਫਿਰ ਯਾਦਾਂ ਕਿਵੇਂ ਬਣਨਗੀਆਂ ਇਹ ਫੋਟੋਆਂ ਹੀ ਤਾਂ ਹੁੰਦੀਆਂ ਜਿਹੜੀਆਂ ਯਾਦਾਂ ਬਣਾਉਂਦੀਆਂ ਹਨ ਇਸ ਕਰਕੇ ਮੈਨੂੰ ਫੋਟੋਆਂ ਦਾ ਸ਼ੌਂਕ ਜਾਗ ਪਿਆ ਅਤੇ ਆਪਣੀ ਜ਼ਿੰਦਗੀ ਦੀ ਹਰ ਇੱਕ ਮੈਮਰੀ ਨੂੰ ਮੈਂ ਫੋਟੋਆਂ ਦੇ ਵਿੱਚ ਖਿੱਚਣਾ ਚਾਹੁੰਦੀ ਹਾਂ ਬਸ ਆਹ ਹੀ ਚਾਹੁੰਦੀ ਹਾਂ